ਮੇਰਾ ਪਹਿਲਾ ਐਕਸਪੀਰੀਅੰਸ ਸੀਗਾ ਕਿ ਹਾਂ ਜਦੋਂ ਮੈਂ ਚੀਜ਼ ਮੰਗਵਾਈ ਸੀ ਮੇਰੀ ਪਹਿਲੀ ਚੀਜ਼ ਸੀਗੀ ਕੰਨਾਂ ਦੇ ਝੁਮਕੇ ਜੋ ਕਿ ਬਹੁਤ ਹੀ ਜ਼ਿਆਦਾ ਵਧੀਆ ਆਏ ਸ ਸੀਗੇ ਕਿਉਂਕਿ ਜਦੋਂ ਵੀ ਆਪਾਂ ਕੋਈ ਚੀਜ਼ ਮੰਗਵਾਉਂਦੇ ਹਾਂ ਸਾਡਾ ਸਭ ਤੋਂ ਪਹਿਲਾ ਡਰ ਇਹ ਹੀ ਹੁੰਦਾ ਕਿ ਉਹ ਚੀਜ਼ ਦੀ ਕੁਆਲਿਟੀ ਕਿਵੇਂ ਦੀ ਹੋਵੇਗੀ ਉਹ ਵਧੀਆ ਚੀਜ਼ ਹੋਵੇਗੀ ਕਿ ਨਹੀਂ ਹੋਵੇਗੀ ਕਿਉਂਕੀ ਸਭ ਤੋਂ ਜ਼ਿਆਦਾ ਵੱਡਾ ਡਰ ਹੁੰਦਾ ਹੈ ਕਿਉਂਕਿ ਸਾਨੂੰ ਪਤਾ ਹੁੰਦਾ ਆ ਕਿ ਆਪਾਂ ਉਸ ਚੀਜ਼ ਦੇ ਪੈਸੇ ਖਰਚ ਕੀਤੇ ਹੁੰਦੇ ਹੈ ਅਗਰ ਤਾਂ ਉਹ ਚੀਜ਼ ਸਾਡੀ ਵਧੀਆ ਨਾ ਆਈ ਹੋਵੇ ਇਸ ਲਈ ਮੇਰਾ ਜੋ ਕੰਨਾਂ ਦੇ ਝੁਮਕੇ ਮੰਗਵਾਏ ਸੀ ਉਹ ਬਹੁਤ ਹੀ ਜ਼ਿਆਦਾ ਵਧੀਆ ਆਏ ਸਨ ਕਿ ਹਾਂ ਜਿੰਨੇ ਪੈਸੇ ਮੈਂ ਉਹਨਾਂ 'ਤੇ ਖਰਚ ਕੀਤੇ ਹੈ ਉਹ ਉਵੇਂ ਦੀ ਹੀ ਮੈਨੂੰ ਉਹ ਚੀਜ਼ ਮਿਲੀ ਸੀ ਉਹ ਚੀਜ਼ ਬਹੁਤ ਹੀ ਜ਼ਿਆਦਾ ਵਧੀਆ ਸੀ ਮੇਰੇ ਘਰਦਿਆਂ ਨੇ ਮੇਰੀ ਸਹੇਲੀਆਂ ਨੇ ਮਤਲਬ ਬਹੁਤ ਹੀ ਜ਼ਿਆਦਾ ਵਧੀਆ ਸੀਗੇ ਉਹਨਾਂ ਨੇ ਕਿਹਾ ਸੀ ਇੰਨੀ ਗੱਲ ਕਿ ਉਹ ਬਹੁਤ ਹੀ ਜ਼ਿਆਦਾ ਵਧੀਆ ਹੈਗੇ ਹੈ ਈਵਨ ਕਿ ਮੈਂ ਹਜੇ ਵੀ ਉਹਨਾਂ ਨੂੰ ਪਾ ਕੇ ਰੱਖਦੀ ਹਾਂ ਮੈਂ ਜਦੋਂ ਵੀ ਕਿਸੇ ਤਿਉਹਾਰ 'ਤੇ ਜਾਣਾ ਕਿਸੇ ਪਾਰਟੀ ਵਗੈਰਾ 'ਤੇ ਜਾਣਾ ਹੋਵੇ ਤਾਂ ਮੈਂ ਉਹ ਝੁਮਕੇ ਜ਼ਰੂਰ ਹੀ ਪਾ ਕੇ ਜਾਂਦੀ ਹਾਂ ਅਤੇ ਉਹ ਬਹੁਤ ਹੀ ਜ਼ਿਆਦਾ ਵਧੀਆ ਲੱਗਦੇ ਹਨ ਮਤਲਬ ਕਿਉਹ ਇੱਕ ਤਰ੍ਹਾਂ ਦਾ ਅਟਰੈਕਸ਼ਨ ਅ ਦੂਜਿਆਂ ਨੂੰ ਪੈਦਾ ਕਰਦੇ ਹਨ ਆਕਰਸ਼ਣ ਵਗੈਰਾ ਕਰਦੇ ਹਨ ਕਿਉਂ ਮੇਰੇ ਜਿੰਨੀਆਂ ਵੀ ਸਹੇਲੀਆਂ ਹੈਗੀਆਂ ਉਹ ਵੀ ਕਹਿੰਦੀਆਂ ਹੁੰਦੀਆਂ ਸਨ ਕਿ ਇਹ ਬਹੁਤ ਵਧੀਆ ਹੈਗੇ ਹੈ ਤੂੰ ਕਿੱਥੋਂ ਮੰਗਵਾਏ ਹੈ ਕਿੱਥੋਂ ਲਿਤੇ ਹੈ ਉਹ ਵੀ ਚਾਹੁੰਦੀਆਂ ਹੈ ਕਿ ਉਹ ਉਹ ਵੀ ਇੱਦਾਂ ਦੇ ਝੁਮਕੇ ਮੰਗਾ ਮੰਗਵਾਉਣ ਕਿਉਂਕਿ ਜਦੋਂ ਮੈਂ ਪਹਿਲੀ ਵਾਰ ਉਸ ਝੁਮਕਿਆਂ ਨੂੰ ਦੇਖਿਆ ਤਾਂ ਉਹਦੇ ਵਿੱਚ ਬਹੁਤ ਹੀ ਵਧੀਆ ਤਰ੍ਹਾਂ ਦੀ ਚਮਕੀਲਾਪਨ ਸਟੋਨਸ ਮਤਲਬ ਬਹੁਤ ਹੀ ਜ਼ਿਆਦਾ ਵਧੀਆ ਤਰ੍ਹਾਂ ਉਹਦੇ ਇਨ ਡਿਟੇਲ ਕੰਮ ਕੀਤਾ ਗਿਆ ਹੋਇਆ ਸੀ ਉਹਨਾਂ ਦਾ ਅਗਰ ਦੇਖਿਆ ਜਾਵੇ ਉਹਨਾਂ ਦਾ ਭਾਰ ਉਹ ਉਹ ਵੀ ਬਹੁਤ ਹੀ ਜ਼ਿਆਦਾ ਅਲਾਈਟ ਸੀਗਾ ਮਤਲਬ ਜ ਨਾ ਜ਼ਿਆਦਾ ਭਾਰੀ ਸੀ ਨਾ ਜ਼ਿਆਦਾ ਘੱਟ ਸੀ ਬਹੁਤ ਹੀ ਜ਼ਿਆਦਾ ਵਧੀਆ ਸੀਗਾ ਮੇਰਾ ਪਹਿਲਾ ਜੋ ਸੀਗਾ ਐਕਸਪੀਰੀਅੰਸ ਉਹ ਬਹੁਤ ਹੀ ਜ਼ਿਆਦਾ ਵਧੀਆ ਸੀ ਜੋ ਮੈਂ ਤੁਹਾਨ ਤੁਹਾਡੇ ਨਾਲ ਸਾਂਝਾ ਕੀਤਾ